ਸਕਰੈਚ ਤੋਂ ਅਸੀਂ ਬਹੁਤ ਤਰ੍ਹਾਂ ਦੇ ਪਕਵਾਨ ਬਣਾਉਂਦੇ ਹਾਂ ਜ਼ਿਆਦਾ ਇਹ ਫਾਇਦਾ ਹੁੰਦਾ ਹੈ ਕਿ ਕੋਈ ਵੀ ਚੀਜ਼ ਅਜਾਈ ਨਹੀਂ ਜਾਂਦੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਸਾਡੇ ਘਰ ਵਿੱਚ ਜ਼ਿਆਦਾ ਬਣੀਆਂ ਰੋਟੀਆਂ ਆਮ ਤੌਰ 'ਤੇ ਵੱਧ ਜਾਂਦੀਆਂ ਨੇ ਜਿਹਨਾਂ ਨੂੰ ਅਸੀਂ ਬਰੈੱਡ ਚੂਰਮਾਂ ਬਣਾ ਕੇ ਵਰਤੋਂ ਵਿੱਚ ਲਿਆਉਂਦੇ ਹਾਂ ਅਤੇ ਖਾ ਕੇ ਬੱਚੇ ਵੀ ਬਹੁਤ ਖੁਸ਼ ਹੁੰਦੇ ਨੇ ਅਜਿਹਾ ਕਰਨਾ ਮੈਨੂੰ ਮੇਰੀ ਮਾਂ ਨੇ ਪ੍ਰੇਰਿਤ ਕੀਤਾ ਸੀ